ਦੇਖੋ ਜੀ ਇੱਕੀਵੀਂ ਸਦੀ ਵਿੱਚ ਨਿਊਜ਼ ਮੀਡੀਆ ਦਾ ਇੱਕ ਵੱਡਾ ਸਾਧਨ ਬਣ ਗਿਆ ਕੋਈ ਵੀ ਕਿਤੇ ਕਾਰਵਾਈ ਹੁੰਦੀ ਆ ਕੋਈ ਐਕਸੀਡੈਂਟ ਹੁੰਦਾ ਕੋਈ ਰੈਲੀ ਧਰਨਾ ਕੋਈ ਗਲਤ ਕੰਮ ਸਾਰਾ ਕੁਛ ਕੀ ਆ ਇਹ ਮੀਡੀਆ ਦੇ ਥਰੂ ਲੋਕਾਂ ਕੋਲ ਪਹੁੰਚ ਜਾਂਦਾ ਜਿਵੇਂ ਕਿ ਹੁਣ ਤੁਸੀਂ ਦੇਖ ਲਓ ਦੋ ਦਿਨ ਪਹਿਲਾਂ ਬਾਰਿਸ਼ ਹੋਈ ਆ ਅਖਬਾਰਾਂ ਦੇ ਵਿੱਚ ਕੀ ਆ ਟੀ ਵੀ 'ਤੇ ਦੇਖੋ ਤੁਸੀਂ ਮੋਬਾਇਲ 'ਤੇ ਦੇਖੋ ਸਾਰਾ ਕੁਛ ਇਹ ਚੱਲ ਰਿਹਾ ਕਿਹੜੇ ਜਿਲ੍ਹਿਆਂ ਦੇ ਵਿੱਚ ਵੱਧ ਬਾਰਿਸ਼ ਹੋਊਗੀ ਕਿਹੜਿਆਂ 'ਚ ਘੱਟ ਹੋਊਗੀ ਕਿੱਥੇ ਆਂਧੀ ਤੂਫਾਨ ਸਾਰਾ ਕੁਝ ਆਊਗਾ ਇਹ ਵੀ ਇੱਕ ਮੀਡੀਆ ਦਾ ਸਾਧਨ ਬਣ ਗਿਆ ਸਾਡੇ ਵਾਸਤੇ ਜਿਹੜੇ ਲੋਕਾਂ ਨੂੰ ਤੁਰੰਤ ਉਸੇ ਟਾਈਮ ਕੀ ਹੈ ਖਬਰ ਮਿਲ ਜਾਂਦੀ ਆ ਦੂਸਰਾ ਕੋਈ ਐਕਸੀਡੈਂਟ ਹੁੰਦਾ ਘਰੇ ਨਹੀਂ ਪਤਾ ਲੱਗਦਾ ਮੀਡੀਆ ਨੇ ਇੰਨੀ ਤਰੱਕੀ ਕੀਤੀ ਆ ਉਹ ਗੱਡੀ ਦਾ ਨੰਬਰ ਵੀ ਆਹ ਨੰਬਰ ਦੀ ਗੱਡੀ ਆ ਫਲਾਣੇ ਏਰੀਏ ਦੇ ਵਿੱਚ ਉਹਦਾ ਐਕਸੀਡੈਂਟ ਹੋ ਗਿਆ ਉਹ ਗਰੁੱਪਾਂ ਦੇ ਵਿੱਚ ਅਲੱਗ ਅਲੱਗ ਸ਼ੇਅਰ ਕਰ ਦਿੰਦੇ ਆ ਅਤੇ ਫਟਾਫਟ ਕੀ ਆ ਉਹ ਘਰ ਦੇ ਤੱਕ ਖਬਰ ਪਹੁੰਚ ਜਾਂਦੀ ਹੈ ਦੂਜਾ ਮੀਡੀਆ ਨੇ ਅਗਰ ਕੋਈ ਕੰਮ ਵਧੀਆ ਹੁੰਦਾ ਉਹਦੀ ਵੀ ਵਧੀਆ ਉਹ ਖਬਰ ਲਾਉਂਦੇ ਆ ਖਾਸ ਕਰਕੇ ਅਗਰ ਕੋਈ ਵਿਰੋਧਤਾ ਵਾਲਾ ਉਹਦਾ ਕੀ ਆ ਮੀਡੀਆ ਦੇ ਥਰੂ ਲੋਕਾਂ ਤੱਕ ਸੁਨੇਹਾ ਪਹੁੰਚਦਾ ਇਸ ਜਗ੍ਹਾ ਦੇ ਵਿੱਚ ਕੋਈ ਨਸ਼ਾ ਵਿਕ ਰਿਹਾ ਡਕੈਤੀ ਹੋ ਰਹੀ ਆ ਆਹ ਜਿਹੜਾ ਸੈਸੀਟਿਵ ਏਰੀਆ ਇਹ ਤੋਂ ਬਚ ਕੇ ਰਹੋ ਇਹ ਸਾਰੀਆਂ ਗੱਲਾਂ ਬਾਤਾਂ ਕੀ ਆ ਇਹ ਇੱਕ ਮੀਡੀਆ ਦੀ ਦੇਣ ਆ ਅਤੇ ਲੋਕਾਂ ਦੇ ਵਾਸਤੇ ਇਹ ਬਹੁਤ ਵਧੀਆ ਸਹੂਲਤ ਬਣ ਗਈ ਆ ਮੀਡੀਆ ਦੀ ਮੀਡੀਆ ਕੋਲ ਕੋਈ ਵੀ ਤੁਸੀਂ ਖਬਰ ਲਵਾਉਣੀ ਹੈ ਜਾ ਕੇ ਦੱਸੋ ਕਿਸੇ ਨੇ ਸ਼ਾਦੀ ਕਰਨੀ ਆ ਕਿਸੇ ਨੇ ਬੇਦਖਲੀ ਨੋਟਸ ਲਾਉਣਾ ਕੁਛ ਵੀ ਆ ਕੋਈ ਵਰ ਚਾਹੀਦੇ ਆ ਕੰਨਿਆ ਚਾਹੀਦੀ ਆ ਕੁਛ ਵੀ ਆ ਪੜ੍ਹਾਈ ਲਿਖਾਈ ਕੋਈ ਕਰਮਚਾਰੀ ਚਾਹੀਦੇ ਆ ਸਾਰਾ ਕੁਛ ਇਹ ਇੱਕ ਮੀਡੀਆ ਦਾ ਦੇਣ ਆ ਇਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ